ਅੱਜ ਦੇ ਸਮੇਂ ਵਿੱਚ ਲੜਕੇ ਅਤੇ ਲੜਕੀਆਂ ਦੀ ਵਿੱਦਿਆ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਅੰਤਰ ਨਹੀਂ ਹੈ ਖਾਸ ਤੌਰ 'ਤੇ ਲੜਕੀਆਂ ਜੋ ਹਨ ਉਹ ਵਿੱਦਿਆ ਦੇ ਖੇਤਰ ਵਿੱਚ ਲੜਕਿਆਂ ਨੂੰ ਪਿੱਛੇ ਛੱਡ ਰਹੀਆਂ ਹਨ ਜੇ ਅਸੀਂ ਪੁਰਾਣੇ ਨਤੀਜਿਆਂ ਦੇ ਉੱਤੇ ਝਾਤੀ ਮਾਰੀਏ ਤਾਂ ਕੰਪੀਟੀਟਿਵ ਐਗਜਾਮ ਜਿੱਦਾਂ ਆਈ ਏ ਐੱਸ ਪੀ ਸੀ ਐੱਸ ਜਾਂ ਹੋਰ ਤਰ੍ਹਾਂ ਦੇ ਐਗਜ਼ਾਮਜ ਦੇ ਵਿੱਚ ਲੜਕੀਆਂ ਨੇ ਹਮੇਸ਼ਾ ਹੀ ਲੜਕਿਆਂ ਨੂੰ ਪਿੱਛੇ ਛੱਡਿਆ ਹੈ ਜੇ ਮੈਂ ਆਪਣੀ ਬੇਟੀ ਦੀ ਗੱਲ ਕਰਾਂ ਤਾਂ ਉਹ ਇਸ ਸਮੇਂ ਸਕੂਲ ਦੇ ਵਿੱਚ ਪੜ੍ਹ ਰਹੀ ਹੈ ਅਤੇ ਮੈਂ ਕਦੇ ਵੀ ਉਸਨੂੰ ਕਿਸੇ ਖ਼ਾਸ ਤਰ੍ਹਾਂ ਦੇ ਕਿਸੇ ਕੋਰਸ ਦੇ ਲਈ ਜਾਂ ਕੈਰੀਅਰ ਦੇ ਲਈ ਫੋਰਸ ਨਹੀਂ ਕਰਾਂਗਾ ਤਾਂ ਜਿਸ ਪਾਸੇ ਉਸਦਾ ਰੁਝਾਨ ਹੋਏਗਾ ਤਾਂ ਉਸ ਤਰ੍ਹਾਂ ਦਾ ਕੋਰਸ ਚੁਣਨ ਦੀ ਉਸਨੂੰ ਪੂਰੀ ਆਜ਼ਾਦੀ ਹੋਵੇਗੀ ਅਤੇ ਮੈਨੂੰ ਨਹੀਂ ਲੱਗਦਾ ਕਿ ਅੱਜ ਦੇ ਸਮੇਂ ਵਿੱਚ ਕੁਛ ਇਸ ਤਰ੍ਹਾਂ ਦੀਆਂ ਮੁਸ਼ਕਿਲਾਂ ਜੋ ਕਿ ਪੁਰਾਣਿਆਂ ਸਮਿਆਂ ਦੇ ਵਿੱਚ ਲੜਕੀਆਂ ਨੂੰ ਪੇਸ਼ ਆਉਂਦੀਆਂ ਸਨ ਵਿੱਦਿਆ ਨੂੰ ਅੱਗੇ ਤੋਰਨ ਦੇ ਲਈ ਤਾਂ ਉਸ ਤਰ੍ਹਾਂ ਦੀਆਂ ਮੁਸ਼ਕਿਲਾਂ ਅੱਜ ਦੇ ਸਮੇਂ ਦੇ ਵਿੱਚ ਨਹੀਂ ਹਨ ਬਲਕਿ ਅੱਜ ਦੇ ਸਮੇਂ ਦੇ ਵਿੱਚ ਤਾਂ ਬਹੁਤ ਸਾਰੀਆਂ ਇੱਦਾਂ ਦੀਆਂ ਸਰਕਾਰੀ ਸਕੀਮਾਂ ਹਨ ਜੋ ਕਿ ਲੜਕੀਆਂ ਨੂੰ ਉਤਸ਼ਾਹਿਤ ਕਰਦੀਆਂ ਹਨ ਅੱਗੇ ਪੜ੍ਹਨ ਦੇ ਲਈ